ਵਧੀਆ ਕਰਮਿਆ ਤੂੰ ਦੱਸ ਤੇਰਾ ਕੀ ਹਾਲ ਆ ਕੁਝ ਨਹੀਂ ਵੀਰੇ ਬਸ ਫਸਲਾਂ ਨਾਲ ਹੀ ਲੱਗਾ ਰਹਿੰਦਾ ਕੁਝ ਨਹੀਂ ਵੀਰੇ ਉਸਨੇ ਤਾਂ ਬੜੀ ਹੀ ਵਧੀਆ ਗ ਕੰਮ ਕੀਤਾ ਹੈ ਹਾਂ ਵੀਰੇ ਹਰੀ ਕ੍ਰਾਂਤੀ ਨਾਲ ਤਾਂ ਫਸਲਾਂ ਦੀ ਪੈਦਾਵਾਰ ਬੜੀ ਵਧੀਆ ਹੋਈ ਹੈ ਇਸ ਵਾਰ ਤਾਂ ਪੱਕਾ ਹੀ ਕਣਕ ਨਿਕਲੇਗੀ ਚਾਵਲ ਦੀ ਖੇਤੀ ਵੀ ਬੜੀ ਵਧੀਆ ਨਿਕਲੀ ਸੀ ਵੀਰੇ ਬੜਾ ਪੈਸਾ ਆਇਆ ਉਹਦੇ 'ਚ ਵੀ ਹਾਂ ਕਿਸਾਨਾਂ ਦਾ ਤਾਂ ਜ਼ਰੂਰ ਸੁਧਾਰ ਕੀਤਾ ਹੈ ਬਾਦਲ ਸਰਕਾਰ ਨੇ ਹਰੀ ਕ੍ਰਾਂਤੀ ਦਾ ਨਿਕਾਸ ਕਰਕੇ ਸਰਕਾਰ ਬਸ ਹਰੀ ਕ੍ਰਾਂਤੀ ਹਰੀ ਕ੍ਰਾਂਤੀ ਨੂੰ ਹੀ ਮਹੱਤਵ ਦਿੱਤਾ ਹੈ ਜ਼ਿਆਦਾ ਹਰੀ ਕ੍ਰਾਂਤੀ ਹੀ ਲਿਆਈ ਹੈ ਸਰਕਾਰ ਨੇ ਉਸ ਨਾਲ ਤਾਂ ਫਸਲਾਂ ਵੀ ਬੜੀਆਂ ਚੰਗੀਆਂ ਨਿਕਲਦੀਆਂ ਪਾਣੀ ਵੀ ਖੇਤਾਂ ਨੂੰ ਪੂਰੇ ਟਾਈਮ 'ਤੇ ਪਹੁੰਚਦਾ ਹਾਂ ਵੀਰੇ ਇਹ ਹੀ ਤਾਂ ਗੱਲ ਹੈ ਸਰਕਾਰ ਨੇ ਸੋਚਿਆ ਕਿਸਾਨਾਂ ਬਾਰੇ ਹਾਂ ਹਾਂ ਵੀਰੇ ਕਿਸਾਨਾਂ ਦਾ ਤਾਂ ਵਾਧਾ ਹੀ ਕੀਤਾ ਸਰਕਾਰ ਨੇ ਬਸ ਠੀਕ ਹੋ ਰਹੀ ਹੈ ਠੀਕ ਸਭ ਫਸਲ ਵਧੀਆ ਨਿਕਲਦੀ ਪਈ ਹੈ ਇਸ ਵਾਰ ਤਾਂ ਵੀਰੇ ਤੂੰ ਦੱਸ ਤੇਰਾ ਤੇਰੀਆਂ ਫਸਲਾਂ ਕਿੱਦਾਂ ਹਾਂ ਵੀਰੇ ਇਹ ਤਾਂ ਹੈ ਹੋਰ ਵੀਰੇ